ਹਾਂਜੀ ਸਰ ਹੈਲੋ ਸਤਿ ਸ਼੍ਰੀ ਅਕਾਲ ਸਰ ਹਾਂਜੀ ਸਰ ਕਰ ਦਾਂਗੇ ਸਰ ਨਹੀਂ ਸਰ ਪਹਿਲੇ ਏਰੀਏ ਦੇ ਤਾਂ ਕੋਈ ਗੱਲ ਨਹੀਂ ਜਿੱਥੇ ਕਹੋਗੇ ਸਰ ਅਸੀਂ ਉੱਥੇ ਤੁਹਾਡੇ ਘਰ ਦੀ ਫਿਟਿੰਗ ਕਰ ਦਾਂਗੇ ਸਰ ਉਝ ਤਾਂ ਜੀ ਕਰ ਦਾਂਗੇ ਏਰੀਆ ਦਸ ਦੇਣਾ ਸਰ ਕਿੰਨਾ ਹੈਗਾ ਸਰ ਓਕ ਹਾਂਜੀ ਸਰ ਠੀਕ ਹੈ ਸਰ ਹਾਜੀ ਸਰ ਮੰਨ ਲਾਂਗੇ ਸਰ ਸਾਡੀ ਫਿਟਿੰਗ ਹੁੰਦੀ ਹੈ ਸਰ ਅਸੀਂ ਪਰ ਸਕੇਅਰ ਫੀਟ ਦੀ ਪੈਸੇ ਲੈਂਦੇ ਹਾਂ ਸਰ ਕਰ ਜਦੋਂ ਲਵਾਂਗੇ ਸਰ ਮਤਲਬ ਕਿ ਸਰ ਇੱਕ ਤਾਂ ਤੁਹਾਡੇ ਗਾ ਵੀ ਅਸੀਂ ਸਰ ਪਾਈਪਾਂ ਪਾਵਾਂਗੇ ਪਾਈਪਾਂ ਹੋ ਗਈਆਂ ਸਰ ਇੱਕ ਵਾਏਰਿੰਗ ਹੋ ਗਈ ਜਿਹੜੀ ਸਰ ਤੁਸੀਂ ਪਵਾਉਣੀ ਵਿੱਚ ਇੱਕ ਸਰ ਤੁਹਾਡਾ ਬੋਡ ਵਗੈਰਾ ਲੱਗਣਗੇ ਸਰ ਠੀਕ ਹੈ ਉਹਨਾਂ ਦੇ ਜਿਵੇਂ ਤੁਸੀਂ ਸਰ ਤਾਰ 'ਚੋਂ ਉਹ ਮਤਲਬ ਕਿ ਜੇ ਵੀ ਪੱਖੇ ਕਿੰਨੇ ਲਵਾਉਣੇ ਹੈ ਸਰ ਉਹ ਮੈਂ ਹਿਸਾਬ ਨਾਲ ਬੋਡ ਬਟਨ ਲੱਗਣਗੇ ਕਿੰਨੀਆਂ ਲਾਈਟਾਂ ਰੱਖਣੀਆਂ ਨੇ ਕਮਰੇ 'ਚ ਟੀ ਵੀ ਦੀ ਤਾਰ ਵੱਖਰੀ ਪਵਾਉਣੀ ਹੈ ਕਿ ਕਿਵੇਂ ਕਰਨੀ ਹੈ ਸਰ ਉਹ ਤੁਸੀਂ ਦੱਸੋਗੇ ਉਦੋਂ ਅਤੇ ਹੋਰ ਸਰ ਜੇ ਤੁਸੀਂ ਏ ਸੀ ਵਗੈਰਾ ਦੀ ਫਿਟਿੰਗ ਕਰਾਓਗੇ ਫਿਰ ਤੁਹਾਨੂੰ ਸਰ ਥੋੜ੍ਹੀ ਜਿਹੀ ਮਤਲਬ ਕਿ ਵਾਇਰ ਵਧੀਆ ਯੂਜ ਕਰਨੀ ਪੈਣੀ ਨੇ ਕਿ ਕੱਲ੍ਹ ਨੂੰ ਕੋਈ ਮਿਸਹੈਪਨਿੰਗ ਨਾ ਹੋਵੇ ਸਰ ਹਾਂਜੀ ਸਰ ਤੁਸੀਂ ਮਤਲਬ ਕਿ ਜੇ ਵਧੀਆ ਕਰਾਓਗੇ ਸਰ ਵਧੀਆ ਮਟੀਰੀਅਲ ਲਾ ਕੇ ਵਧੀਆ ਹੋਵੇਗੀ ਸਰ ਕਿ ਕੱਲ੍ਹ ਨੂੰ ਕੋਈ ਫਾਇਰ ਵਗੈਰਾ ਅੱਗ ਅੱਗ ਵਗੈਰਾ ਦੀ ਤੁਹਾਨੂੰ ਪ੍ਰੋਬਲਮ ਨਾ ਆਵੇ ਸਰ ਅਤੇ ਨਾ ਕੋਈ ਸ਼ੋਟ ਸਰਕਟ ਨਾ ਆਵੇ ਹਾਂਜੀ ਸਰ ਸਾਡੇ ਕੋਲ ਸਾ ਹਰ ਤਰ੍ਹਾਂ ਦੀ ਅਸੀਂ ਮਾਲ ਅ ਮਤਲਬ ਕਿ ਸੇਲਸਮੈਨ ਵੀ ਕਰਦੇ ਹਾਂ ਸਰ ਇਲੈਕਟ੍ਰੀਸ਼ਨ ਦਾ ਅਸੀਂ ਵੇਚਦੇ ਵੀ ਹਾਂ ਸਰ ਮਤਲਬ ਕਿ ਸਰ ਸਾਡੇ ਕੋਲ ਤੁਸੀਂ ਇੱਕ ਦਿਨ ਆਇਆ ਜੇ ਸਰ ਇੱਕ ਤਾਂ ਸਾਡੇ ਕੋਲ ਸਾਰਾ ਮਟੀਰੀਅਲ ਵੇਖ ਲਿਆ ਜੇ ਸਰ ਹਲਕੇ ਤੋਂ ਹਲਕਾ ਵੀ ਪਿਆ ਸਰ ਮਹਿੰਗੇ ਤੋਂ ਮਹਿੰਗਾ ਵੀ ਪਿਆ ਸਰ ਲੇਕਿਨ ਸਰ ਅਸੀਂ ਤੁਹਾਨੂੰ ਕਵਾਂਗੇ ਸਰ ਤੁਸੀਂ ਵੀ ਬ੍ਰਾਂਡਿਡ ਕੰਪਨੀ ਦਾ ਲਾਓ ਸਰ ਜਿਵੇਂ ਫਿਲਿਪ ਦਾ ਹੋ ਗਿਆ ਸਰ ਫਿਲਿਪਸ ਦੇ ਮਤਲਬ ਕਿ ਸਰ ਇੱਕ ਤਾਂ ਹੈਗੀ ਲਾਈਟਨਿੰਗ ਵਗੈਰਾ ਬਹੁਤ ਵਧੀਆ ਹੋਵੇਗੀ ਸਰ ਜਿਵੇਂ ਮਤਲਬ ਕਿ ਜਿਹੜੀ ਟਿਊਬਸ ਹੋਣਗੀਆਂ ਉਹ ਘੱਟ ਪੀ ਮਤਲਬ ਕਿ ਬਿਜਲੀ ਘੱਟ ਪੀਣਗੀਆਂ ਠੀਕ ਹੈ ਇਹਨਾ ਦਾ ਤਾਂ ਸਰ ਪੱਖੇ ਵੀ ਬਹੁਤ ਵਧੀਆ ਕੰਪਨੀ ਦੇ ਹੋਣਗੇ ਸਰ ਮਤਲਬ ਕਿ ਜਲਦੀ ਖ਼ਰਾਬ ਵੀ ਨਹੀਂ ਹੋਣਗੇ ਹਾਂਜੀ ਸਰ ਫੀਲਿਪਸ ਵਾਲੇ ਸਾਲ ਦੀ ਸਰ ਗਰੰਟੀ ਸਾਲ ਦੀ ਗਰੰਟੀ ਵੀ ਦੇਵਾਂਗੇ ਸਰ ਟਿਊਬਸ ਦੀ ਬੱਲਬ ਦੀ ਸਰ ਦੋ ਸਾਲਾਂ ਦੀ ਦੇਵਾਂਗੇ ਸਰ ਮਤਲਬ ਕਿ ਸਾਡਾ ਤੁਹਾਨੂੰ ਇੱਕ ਵਾਰੀ ਰੇਟ ਥੋੜ੍ਹਾ ਜ਼ਿਆਦਾ ਲੱਗੇਗਾ ਸਰ ਤੁਸੀਂ ਫਿਰ ਘਰ 'ਚ ਸੈਟ ਕਰਾ ਲੋਗੇ ਸਰ ਤੁਹਾਨੂੰ ਬਹੁਤ ਵਧੀਆ ਲੱਗਣਗੀਆਂ ਸਰ ਇੱਕ ਤਾਂ ਸਰ ਤੁਹਾਡੇ ਕਮ ਕਮਰੇ 'ਚ ਮਤਲਬ ਕਿ ਰੋਸ਼ਨੀ ਵੀ ਵਧੀਆ ਜ਼ਿਆਦਾ ਹੋਵੇਗੀ ਨਾਲੇ ਜਦੋਂ ਅਸੀਂ ਫੀਟਿੰਗ ਕਰਦੇ ਹਾਂ ਸਰ ਸਾਡਾ ਹੁੰਦਾ ਅਸੀਂ ਛੇ ਮਹੀਨੇ ਮਤਲਬ ਕਿ ਕਰਕੇ ਦਿੰਦੇ ਜੋ ਤੁਹਾਨੂੰ ਕੋਈ ਵੀ ਦਿੱਕਤ ਆਏ ਫਰੀ ਕਰਕੇ ਦੇਵਾਂਗੇ ਸਰ ਸਰਵਿਸ ਸਾਡੀ ਆਪਣੀ ਹੈ ਮਤਲਬ ਕਿ ਤੁਹਾਨੂੰ ਸਰ ਕੱਲ੍ਹ ਨੂੰ ਕੋਈ ਵੀ ਪ੍ਰੋਬਲਮ ਆ ਜਾਵੇ ਅਸੀਂ ਇਹ ਨਹੀਂ ਕਹਾਂਗੇ ਅਸੀਂ ਅਸੀਂ ਨਹੀਂ ਕਰਾਂਗੇ ਅਸੀਂ ਫਰੀ ਫਰੀ ਆਫ ਕੋਸਟ ਕਰਕੇ ਦੇਵਾਂਗੇ ਸਰ ਸਾਨੂੰ ਸਰ ਚਾਰਜਿਸ ਸਾਰੇ ਥੋੜ੍ਹੇ ਜ਼ਿਆਦਾ ਪੇ ਕਰਨੇ ਪੈਣਗੇ ਐਡਵਾਂਸ 'ਚ ਮਤਲਬ ਕਿ ਅਸੀੰ ਸਰ ਪੰਜ ਰੁਪਏ ਸਕੇਅਰ ਫੁੱਟ ਲੈਂਦੇ ਹਾਂ ਸਰ ਵਾਈਰਿੰਗ ਦਾ ਇੱਕ ਦਾ ਮਤਲਬ ਕਿ ਸਰ ਜੇ ਮੰਨ ਲਓ ਦਾ ਦਸ ਸਕੇਅਰ ਫੁੱਟ ਹੋ ਜਾਵੇਗਾ ਸਰ ਕੁਲ ਮਿਲਾ ਕੇ ਕਿੰਨੇ ਕਿੰਨੇ ਬਾਏ ਗਜ ਦਾ ਮਕਾਨ ਹੈ ਸਰ ਤੁਹਾਡਾ ਦਸ ਬਾਏ ਦਸ ਗਜ ਸਰ ਮੰਨ ਕੇ ਚੱਲੋ ਪ੍ਰੋਪਰ ਫਿਟਿੰਗ ਟੀ ਵੀ ਵਗੈਰਾ ਦੀ ਵੀ ਕਰਾ ਕੇ ਵੀ ਸਰ ਤੁਹਾਨੂੰ ਲੱਗ ਜੇਗਾ ਨਹੀਂ ਸਰ ਤੁਸੀਂ ਪੱਖੇ ਸਰ ਭਾਵੇਂ ਤਾਂ ਤੁਸੀਂ ਆਪ ਲੈ ਆਇਓ ਸਰ ਕਈ ਸਰ ਫੀਟਿੰਗ ਗਲਤ ਕਰ ਦਿੰਦੇ ਕਈ ਵਰੀ ਹਵਾ ਨਹੀਂ ਆਉਦੀ ਸਰ ਅਸੀਂ ਤੁਹਾਨੂੰ ਪ੍ਰੋਪਰ ਚੈੱਕ ਕਰਾਂਗੇ ਅਸੀਂ ਫਿਟਿੰਗ ਕਰਾਂਗੇ ਪੱਖਾ ਸਰ ਚਲਾ ਕੇ ਦਿਖਾਵਾਂਗੇ ਜੇ ਤਾਂ ਜਦੋਂ ਤੱਕ ਤੁਹਾਨੂੰ ਮਤਲਬ ਕਿ ਸੰਤੁਸ਼ਟੀ ਨਹੀਂ ਹੁੰਦੀ ਸਰ ਪ੍ਰੋਪਰ ਪੱਖੇ ਚਲਾ ਕੇ ਦਿਖਾਵਾਂਗੇ ਸਰ ਜੇ ਤੁਸੀਂ ਕਹੋਗੇ ਕਿ ਵਧੀਆ ਲੱਗਿਆ ਸੀ ਸਰ ਦੁਬਾਰਾ ਲਾ ਕੇ ਵਿਖਾਵਾਂਗੇ ਫਿਟਿੰਗ ਵੱਲੋਂ ਸਰ ਕੋਈ ਕੰਪਲੇਂਟ ਨਹੀਂ ਹੈਗੀ ਸਰ ਤੁਹਾਨੂੰ ਠੀਕ ਹੈ ਸਰ